ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਇੱਥੇ ਕੋਰਸ ਦੇ ਵਿੱਚ ਇੱਕ ਜੋਇਨ ਕਰਨਾ ਚਾਹੁੰਦੀ ਹਾਂ ਪਰ ਜਿਹਦੇ 'ਚ ਮੇਰਾ ਮੇਨ ਮੁੱਦਾ ਰਹੇਗਾ ਕਿ ਮੈਨੂੰ ਅੱਛੀ ਜਿਹੀ ਨੌਕਰੀ ਮਿਲ ਜਾਵੇ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਕੀ ਕਰਾਂ ਮੈਂ ਆਫਿਸ ਦੀ ਜੋਬ ਦੇਖਣਾ ਚਾਹੁੰਦੀ ਹਾਂ ਕੋਈ ਜਿੱਥੇ ਔਫਿਸ ਵਰਕ ਹੋਵੇ ਜਿਹਦੇ ਵਿੱਚ ਦਿਨ ਵੇਲੇ ਦਾ ਕੰਮ ਹੋਵੇ ਮੈਂ ਰਾਤ ਦੀ ਬਹੁਤ ਲੇਟ ਨਹੀਂ ਕਰ ਸਕਦੀ ਮੇਰਾ ਛੋਟਾ ਬੱਚਾ ਵੀ ਹੈ ਜੀ ਹਾਂਜੀ ਮੇਰੇ ਕੰਪਿਊਟਰ ਵਿੱਚ ਕਾਫ਼ੀ ਅੱਛੀ ਮੇਰੇ ਕੋਲ ਡਿਗਰੀਆਂ ਹੈਗੀਆਂ ਹੈ ਤੁਸੀਂ ਮੈਨੂੰ ਉਹਦੇ ਵਿੱਚ ਕੋਈ ਵਧੀਆ ਨੌਕਰੀ ਦੱਸ ਦਿਓ ਤਾਂ ਮੈਡਮ ਦੂਰ ਨਾ ਕਿਤੇ ਭੇਜਿਓ ਪਿੰਡਾਂ ਵੱਲ ਨਾ ਪਾਇਓ ਮੈਂ ਸ਼ਹਿਰ ਵਿੱਚ ਰਹਿ ਕੇ ਮੇਰਾ ਕੰਮ ਕਰਨਾ ਚਾਹੁੰਦੀ ਨਹੀਂ ਮੈਂ ਆਫਿਸ ਜਾਣਾ ਜ਼ਿਆਦਾ ਪਸੰਦ ਕਰਾਂਗੀ ਮੈਂ ਇਹਨੂੰ ਘਰ ਵਿੱਚ ਨਹੀਂ ਚਾਹੁੰਦੀ ਪਰ ਨੌਕਰੀ ਅੱਛੇ ਪੱਧਰ ਦੀ ਹੋਵੇ ਵੀ ਜਿੱਥੇ ਮੈਨੂੰ ਮੁਸ਼ਕਿਲ ਨਾ ਹੋਵੇ ਮੈਂ ਆਪਣੇ ਘਰ ਦੀ ਵੀ ਨਾਲ ਨਾਲ ਧਿਆਨ ਰੱਖ ਸਕਾਂ ਮੈਨੂੰ ਇਹ ਦੱਸੋ ਭੈਣ ਜੀ ਕੋਈ ਸਰਕਾਰੀ ਨੌਕਰੀ ਵਿੱਚ ਤੁਸੀਂ ਮੇਰੀ ਮਦਦ ਨਹੀਂ ਕਰ ਸਕਦੇ

ਸਰਕਾਰੀ ਨੌਕਰੀ ਦੀ ਕੋਈ ਤਿਆਰੀ ਕਰਵਾ ਦਿਓ ਮੈਨੂੰ ਕੋਈ ਉਮਰ ਦਾ ਵਿਚਕਾਰ ਗੁੰਜਾਇਸ਼ ਤਾਂ ਨਹੀਂ ਉਹਦਾ ਤਾਂ ਨਹੀਂ ਕੁਛ ਪਵੇਗਾ ਕਿ ਮੈਨੂੰ ਉਮਰ ਦੀ ਮੈਂ ਉੱਦਾਂ ਤਾਂ ਪੜ੍ਹੀ ਬਾਰਵੀਂ ਤੋਂ ਅੱਗੇ ਪੜ੍ਹੀ ਹੋਈ ਹਾਂ ਮੈਂ ਕੋ ਕਾਮਰਸ ਦੀ ਕੀਤੀ ਹੋਈ ਹੈ ਪਰ ਮੇਰੇ ਨਾਲ ਕੰਪਿਊਟਰ ਦੇ ਨਾ ਅਲੱਗ ਕੋਰਸ ਵੀ ਕੀਤੇ ਹੋਏ ਆ ਹਾਂਜੀ ਮੇਰੇ ਕੋਲ ਇਸ ਨੰਬਰ 'ਤੇ ਵਟਸਐਪ ਹੈਗਾ ਹੈ ਤੁਸੀਂ ਮੈਨੂੰ ਕਮ ਸੇ ਕਮ ਦ ਚਾਰ ਪੰਜ ਮੈਨੂੰ ਦੱਸ ਦਿਓ ਮੈਂ ਰਾਤੀਂ ਪੂਰੀ ਤਰਾਂ ਦੇਖ ਕੇ ਤੁਹਾਨੂੰ ਫਿਰ ਦੱਸ ਦੇਵਾਂਗੀ ਮੈਂ ਕਿਹਦੇ 'ਚ ਕਰਨਾ ਚਾਹੁੰਦੀ ਹਾਂ ਬਹੁਤ ਵਧੀਆ ਅਤੇ ਮੈਨੂੰ ਇਹ ਦੱਸੋ ਕਿ ਮੇਰਾ ਕੋਈ ਆਪਣਾ ਪੈਸੇ ਤਾਂ ਨਹੀਂ ਲੱਗਣਗੇ ਵੱਖ ਦੇ ਨਾਲ